ਮੈਂ ਆਪਣੇ ਇੰਟਰਨੈਟ ਕਨੈਕਸ਼ਨ ਨੂੰ ਸੁਰੱਖਿਤ ਕਰਨ ਜਾਂ ਆਪਣੀ ਆਨਲਾਈਨ ਪ੍ਰਾਈਵੇਸੀ ਦੀ ਰੱਖਿਆ ਕਰਨ ਲਈ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ ਵੀ ਪੀ ਐਨ ਦੀ ਵਰਤੋਂ ਨਹੀਂ ਕੀਤੀ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜੋ ਕਿ ਮੈਨੂੰ ਆਪਣੇ ਦੋਸਤਾਂ ਜਾਂ ਫਿਰ ਇੰਟਰਨੈਟ ਆਦਿ ਤੋਂ ਪਤਾ ਲੱਗੀ ਹੈ ਉਸ ਦੇ ਮੁਤਾਬਕ ਆਪਾਂ ਇਸਦੀ ਵਰਤੋਂ ਕਰਕੇ ਆਪਣੇ ਲੋਕੇਸ਼ਨ ਦਾ ਬਿਨਾਂ ਪਤਾ ਲੱਗੇ ਆਪਾਂ ਇਸ ਦੀ ਵਰਤੋਂ ਨਾਲ ਕਈ ਚੀਜ਼ਾਂ ਨੂੰ ਐਕਸੈਸ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਕਈ ਵੈ ਅ ਕਈ ਐਪ ਜਾਂ ਵੀਡੀਓਜ ਵਗੈਰਾ ਹੁੰਦੇ ਹਨ ਜੋ ਕਿ ਲੀਗਲ ਨਹੀਂ ਆਪਣੀ ਕੰਟਰੀ ਦੇ ਵਿੱਚ ਲੀਗਲ ਨਹੀਂ ਹੁੰਦੇ ਹਨ ਅਤੇ ਉਹਨਾਂ ਨੂੰ ਦੇਖਣ ਲਈ ਜਾਂ ਫਿਰ ਆਦਿ ਅ ਦੀ ਵਰਤੋਂ ਕਰਨ ਲਈ ਆਪਾਂ ਨੂੰ ਆਪਾਂ ਵੀ ਪੀ ਐਨ ਦੀ ਵਰਤੋਂ ਕਰ ਸਕਦੇ ਹਨ ਜਿਵੇਂ ਕਈ ਐਪ ਜਾਂ ਗੇਮਾਂ ਆਦਿ ਹਨ ਜੋ ਕਿ ਅ ਆਪਣੇ ਦੇਸ਼ ਦੇ ਵਿੱਚ ਅਵੇਲੇਬਲ ਨਹੀਂ ਹਨ ਪਰ ਆਪਾਂ ਉਹਨਾਂ ਵੀ ਪੀ ਐਨ ਦੀ ਵਰਤੋਂ ਕਰਕੇ ਉਹਨਾਂ ਨੂੰ ਡਾਊਨਲੋਡ ਕਰਕੇ ਖੇਡ ਸਕਦੇ ਹਨ ਅਤੇ ਇੰਤ ਇਸ ਨਾਲ ਆਪਣਾ ਬਹੁਤ ਹੀ ਅ ਸਮਾਂ ਬਚਦਾ ਹੈ ਕਿਉਂਕਿ ਕਈ ਵਾਰ ਗੇਮ ਇਹੋ ਜਿਹੀਆਂ ਚੀਜ਼ਾਂ ਨੂੰ ਆਪਣੇ ਦੇਸ਼ ਵਿੱਚ ਆਉਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਇਸ ਕਰਕੇ ਇਹ ਆਪਣਾ ਸਮਾਂ ਵੀ ਬਚਾਉਂਦੀ ਹੈ ਅਤੇ ਇਸ ਨਾਲ ਆਪਣਾ ਬਹੁਤ ਮਿਹਨਤ ਵੀ ਬਚਦੀ ਹੈ ਇਸ ਦੀ ਵਰਤੋਂ ਨਾਲ ਆਪਾਂ ਬਹੁਤ ਕੁਝ ਅ ਕਰ ਸਕਦੇ ਹਾਂ ਅਤੇ ਆਪਣੇ ਇਹ ਪ੍ਰਾਈਵੇਸੀ ਨੂੰ ਵੀ ਬਹੁਤ ਵਧੀਆ ਤੌ ਢੰਗ ਨਾਲ ਬਚਾਉਂਦਾ ਹੈ ਇਸ ਨਾਲ ਇਸ ਦੇ ਬਹੁਤ ਸਾਰੇ ਫਾਇਦੇ ਹਨ